ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਡਾਇਨੂਰ ਜਿੰਮ ਤੋਂ ਬੋਲ ਰਹੇ ਹੋ ਗਿੱਦੜਵਾਹਾ ਸਰ ਮੈਂ ਗਿੱਦੜਵਾਹਾ ਤੋਂ ਨਿਸ਼ਾ ਗੱਲ ਕਰ ਰਹੀ ਹਾਂ ਸਰ ਮੈਂ ਜੁਆਇਨਿੰਗ ਕਰਨਾ ਸੀ ਜਿੰਮ ਜੁਆਇਨ ਕਰਨਾ ਸੀ ਸਰ ਮੇਰਾ ਕਰੰਟ ਵੇਟ ਹੈਗਾ ਅਬਾਊਟ ਸਿਕਸਟੀ ਕੇ ਜੀ ਸੋ ਸਰ ਟੈਲ ਮੀ ਦੈਟ ਮਤਲਬ ਮੈਂ ਕੀ ਕਰ ਸਕਦੀ ਹਾਂ ਵੇਟ ਲੋਸ ਕਰਨ ਲਈ ਓਕੇ ਔਰ ਸਰ ਟਾਈਮਿੰਗ ਦੱਸ ਸਕਦੇ ਹੋ ਮਤਲਬ ਜਿੰਮ ਦਾ ਮੋਰਨਿੰਗ ਟਾਈਮ ਔਰ ਈ ਓਕੇ ਓਕੇ ਔਰ ਸਰ ਉਹ ਕੀ ਕਹਿੰਦੇ ਨੇ ਵੀ ਤੁਸੀਂ ਮੈਨੂੰ ਫੈਸਿਲਿਟੀਜ਼ ਦੱਸ ਸਕਦੇ ਹੋ ਕਿ ਮਤਲਬ ਕੀ ਕੀ ਤੁਹਾਡੇ ਮਤਲਬ ਅ ਮਸ਼ੀਨ 'ਚ ਨੇ ਜਾਂ ਕੀ ਕੀ ਐਕਸਰਸਾਈਜ਼ ਤੁਸੀਂ ਦੱਸਦੇ ਹੋ ਓਕੇ ਓਕੇ ਔਰ ਸਰ ਐਰਸਸਾਈਜ਼

ਓਕੇ ਸਰ ਉਹ ਬੈਕ ਔਰ ਸ਼ੋਲਡਰ ਔਰ ਬਾਈਸੈਪਸ ਰਿਗਾਰਡਿੰਗ ਕੁਛ ਓਕੇ ਔਰ ਕੀ ਮਤਲਬ ਓਕੇ ਓਕੇ ਔਰ ਸਰ ਡਾਇਟ ਰਿਗਾਰਡਿੰਗ ਵੀ ਕੁਛ ਮੈਨੂੰ ਦੱਸ ਦਿਓ ਕਿ ਮੈਂ ਕੀ ਕੀ ਮਤਲਬ ਡਾਇਟ ਲਵਾਂ ਹੈਲਦੀ ਡਾਇਟ ਔਰ ਮਤਲਬ ਵੈਸੇ ਕੁਛ ਫਰੂਟਸ ਵਗੈਰਾ ਕੁਛ ਵੀ ਇਟ ਮੀਨਸ ਕੁਛ ਵੀ ਔਰ ਸੈਲਡ ਵਗੈਰਾ ਮਾਰਨਿੰਗ 'ਚ ਓਕੇ ਥੈਂਕ ਯੂ ਸਰ ਸੋ ਮਚ